ਵੈਸੇ ਤਾਂ ਅਗਰ ਦੇਖਿਆ ਜਾਵੇ ਜਿੱਦਾਂ ਪੰਜਾਬ ਵਿੱਚ ਕੋਈ ਵੀ ਫਸਲ ਹੈਗੀ ਹੈ ਭਾਵੇਂ ਕਿਸੇ ਵੀ ਮਤਲਬ ਕਿਸੇ ਵੀ ਖਿੱਤੇ ਵਿੱਚ ਜਿਹੜੀ ਫਸਲ ਬੀਜੀ ਜਾਂਦੀ ਹੈਗੀ ਹੈ ਉਹ ਸਿਰਫ ਇੱਕੋ ਇੱਕ ਚੀਜ਼ 'ਤੇ ਡਿਪੈਂਡ ਕੀਤੀ ਜਾਂਦੀ ਹੈ ਕਿ ਮੌਸਮ ਜਿੱਦਾਂ ਹੁਣ ਜਿੱਦਾਂ ਦਾ ਮੌਸਮ ਉੱਦਾਂ ਦੀ ਇੱਥੇ ਫਸਲ ਬੀਜੀ ਜਾਂਦੀ ਹੈਗੀ ਹੈ ਜਿੱਦਾਂ ਹੁਣ ਮੰਨ ਲਓ ਜਿਹੜੀ ਇਹ ਹੈਗੀ ਹੈ ਜਿੱਦਾਂ ਹੁਣ ਮੰਨ ਲਓ ਗਰਮੀਆਂ ਦਾ ਸੀਜ਼ਨ ਚੱਲਦਾ ਗਰਮੀਆਂ ਦੇ ਸੀਜ਼ਨ ਵਿੱਚ ਇੱਥੇ ਇੱਥੇ ਕਣਕ ਬੀਜੀ ਜਾਂਦੀ ਹੈਗੀ ਅਤੇ ਝੋਨਾ ਬੀਜਿਆ ਜਾਂਦਾ ਹੈਗਾ ਹੈ ਜਿਹੜੀ ਮੱਕੀ ਹੈਗੀ ਹੈ ਇਹ ਮੱਕੀ ਮੱਕੀ ਬਰਸਾਤ ਦੇ ਮੌਸਮ 'ਚ ਬੀਜੀ ਜਾਂਦੀ ਹੈਗੀ ਹੈ ਕਿਉਂ ਕਿਉਂਕਿ ਕਿਉਂਕਿ ਬਰਸਾਤ ਦੇ ਮੌਸਮ 'ਚ ਇੱਕ ਤਾਂ ਇਹਨੂੰ ਮਤਲਬ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਹੈ ਝੋਨਾ ਵੀ ਬਰਸਾਤ ਦੇ ਮੌਸਮ 'ਚ ਬੀਜਿਆ ਜਾਂਦਾ ਹੈਗਾ ਜ਼ਿਆਦਾਤਰ ਇਹ ਦੋਨੋਂ ਦੋਨੋਂ 'ਚ ਰੱ ਰੱਬੀ ਅਤੇ ਖਰੀਫ ਦੋਨਾਂ ਸੀਜਨਾਂ 'ਚ ਬੀਜਿਆ ਜਾਂਦਾ ਹੈਗਾ ਹੈ ਕਿਉਂਕਿ ਕਿਉਂਕਿ ਜਿਹੜੇ ਦੂਜੇ ਸੀਜ਼ਨ 'ਚ ਬਰਸਾਤ ਵਾਲੇ ਮੌਸਮ 'ਚ ਤਾਂ ਬੀਜਿਆ ਜਾਂਦਾ ਹੈ ਕਿਉਂਕਿ ਲੋਕਾਂ ਨੇ ਇਹਨੂੰ ਪਾਣੀ ਨਹੀਂ ਲਾਉਣਾ ਪੈਂਦਾ ਹੈਗਾ ਜ਼ਿਆਦਾ ਅਤੇ ਇੱਦਾਂ ਹੀ ਮਤਲਬ ਬਿਨਾਂ ਪਾਣੀ ਤੋਂ ਹੀ ਸਰ ਜਾਂਦਾ ਹੈਗਾ ਇਹਦਾ ਉਹ ਤੋਂ ਇਲਾਵਾ ਜਿਹੜੀਆਂ ਹੇਇਆਂ ਹੈ ਜਿਹੜੀਆਂ ਰਸਾਇਣਿਕ ਅਤੇ ਕੀਟਨਾਸ਼ਕ ਜਿਹੜੀਆਂ ਹੇਇਆਂ ਹੈ ਇਹ ਮਿੱਟੀ ਨੂੰ ਬਰਬਾਦ ਕਰਦੇ ਹੈਗੇ ਹੈ ਇਹ ਇਹ ਕਿੱਦਾਂ ਕਰਦੇ ਹੈਗੇ ਹੈ ਇਹਦਾ ਇਹਦਾ ਸਾਰੇ ਨਾਲੋਂ ਬੜਾ ਮੇਨ ਰੀਜ਼ਨ ਹੈਗਾ ਹੈ ਜਿੱਦਾਂ ਹੁਣ ਮੰਨ ਲਓ ਆਪਾਂ ਕਿਤੇ ਵੀ ਮਤਲਬ ਕਿਤੇ ਵੀ ਤਾਂ ਜਿੱਦਾਂ ਹੁਣ ਕੋਈ ਮਤਲਬ ਫਸਲ ਲਗਾ ਦਿੱਤੀ ਹੈਗੀ ਉਦੇ ਆਪਾਂ ਕੋਈ ਵੀ ਫਰਟਲਾਈਜ਼ਰ ਛਿੜਕਾਅ ਦਿੰਦੇ ਹੈਗੇ ਹੈ ਉਹਦੇ ਨਾਲ ਜਿਹੜੇ ਜਿਹੜੀ ਜਿਹੜੀ ਜ਼ਮੀਨ ਦੀ ਜਿਹੜੀ ਨਾਈਟ੍ਰੋਜਨ ਹੁੰਦੀ ਹੈਗੀ ਹੈ ਉਹ ਨਾਈਟ੍ਰੋਜਨ ਇਹਦੀ ਮਾਤਰਾ ਨੂੰ ਘਟਾ ਦਿੰਦਾ ਹੈਗਾ ਜਦ ਜਦੋਂ ਵੀ ਕਿਸੇ ਵੀ ਜ਼ਮੀਨ ਵਿੱਚ ਜਦੋਂ ਉਹਦੀ ਨਾਈਟ੍ਰੋਨਜ ਦੀ ਮਾਤਰਾ ਜਿਹੜੀ ਹੈ ਘੱਟਣ ਲੱਗ ਪੈਂਦੀ ਹੈਗੀ ਹੈ ਤਾਂ ਉਹ ਜਿਹੜੇ ਜਿਹੜੀ ਉਸ ਵਿੱਚ ਜਿਹੜਾ ਜਿਹੜੀ ਚੀਜ਼ ਪੈਦਾ ਹੁੰਦੀ ਹੈਗੀ ਹੈ ਇੱਕ ਤਾਂ ਕਹਿੰਦੇ ਹੈਗੇ ਜਿੱਦਾਂ ਆਪਾਂ ਬੰਦਿਆਂ ਨੂੰ ਕੈਂਸਰ ਹੋ ਗਿਆ ਤਾਂ ਅਸੀਂ ਇੱਕ ਇੱਦਾਂ ਹੁਣ ਹੁਣ ਇਹ ਵੀ ਸੁਣਨ 'ਚ ਆਉਣ ਲੱਗ ਪਿਆ ਵੀ ਜ਼ਮੀਨ ਨੂੰ ਵੀ ਕੈਂਸਰ ਹੋ ਗਿਆ ਤਾਂ ਇੱਦਾਂ ਦੀਆਂ ਜਿਹੜੀਆਂ ਹੇਇਆਂ ਹੈ ਉਹ ਸਾਨੂੰ ਸਾਹਮਣਾ ਆਉਂਦੇ ਹੈਗੇ ਸਾਡਾ ਨਤੀਜੇ ਸਾਰਾ ਕੁਛ ਇੱਦਾਂ ਦੀਆਂ ਮਤਲਬ ਆਉਣਾ ਸ਼ੁਰੂ ਹੋ ਗਿਆ ਵਾ ਹੈਗਾ ਹੈ ਇਸ ਤਰ੍ਹਾਂ ਆਪਾਂ ਜੇ ਰਲਾ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੇ ਜਿਹੜੀ ਕੀਟਨਾਸ਼ਕ ਜਿਹੜੀ ਵੀ ਦਵਾਈਆਂ ਮਤਲਬ ਸ਼ੁਰੂ 'ਚ ਤਾਂ ਇਹ ਮਤਲਬ ਮਿੱਟੀ 'ਤੇ ਪੈਦਾਵਾਰ ਜਿਹੜੀਆਂ ਹੈਗੀਆਂ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਵਾਸਤੇ ਇਹਨਾਂ ਦਾ ਯੂਜ਼ ਕੀਤਾ ਗਿਆ ਸੀਗਾ ਪਰ ਅੱਜ ਕੱਲ੍ਹ ਇਹਨਾਂ ਦਾ ਯੂਜ਼ ਉਹ ਕੀਤਾ ਜਾਂਦਾ ਹੈਗਾ ਇਹਨਾਂ ਦਾ ਯੂਜ਼ ਕਰਨਾ ਸਾਨੂੰ ਨੁਕਸਾਨ ਏ ਹੋ ਰਹੇ ਹੈਗੇ ਹੈ ਨੁਕਸਾਨ ਕਿੱਦਾਂ ਹੋ ਰਹੇ ਹੈਗੇ ਹੈ ਇਹਨਾਂ ਨਾਲ ਸਾਨੂੰ ਜਿਹੜੀਆਂ ਬੀ ਪੀ ਸ਼ੂਗਰ ਵਗੈਰਾ ਅਤੇ ਜਿਹੜੀਆਂ ਹੋਰ ਵੀ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਕੈਂਸਰ ਬ੍ਰੇਨ ਹੈਮਰੇਜ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਸਾਰੀਆਂ ਇਹ ਇਨ੍ਹਾ ਦੀਆਂ ਫਰਟੀਲਾਈਜਰ ਦੀਆਂ ਦੇਣ ਹੈਗੀਆਂ ਹੈ